ਹਾਂ ਮੈਂ ਬਹੁਤ ਵਾਰ ਫਿਲਮੀ ਅਭਿਨੇਤਰੀ ਤੋਂ ਪ੍ਰਭਾਵਿਤ ਹੋ ਕੇ ਸੂਟ ਡਿਜਾਇਨ ਕੀਤਾ ਹੈ ਪਰ ਉਸ ਵਿੱਚ ਬਹੁਤ ਸਾਰੀ ਮੁਸ਼ਕਿਲਾਂ ਆਉਂਦੀਆਂ ਹਨ ਜਿਵੇਂ ਕਿ ਕੱਪੜਾ ਨਾ ਮਿਲਣਾ ਉੱਥੇ ਲਗਾਉਣ ਵਾਲੀ ਲਾਈ ਲਾਈਸ਼ ਏ ਏ ਉਸ ਏਰੀਏ ਵਿੱਚ ਨਾ ਮਿਲਣਾ ਉਸ ਤਰ੍ਹਾਂ ਦੇ ਕਲਰ ਦਾ ਕੱਪੜਾ ਨਾ ਮਿਲਣਾ ਸਟੀਚਿੰਗ ਕਰਨ ਲਈ ਕਈ ਵਾਰ ਸਟਿਚ ਕਰਨ ਲਈ ਬਹੁਤ ਸਾਰੇ ਕੱਪੜੇ ਦਾ ਮਤਲਬ ਖ਼ਰਾਬ ਹੋ ਜਾਣਾ ਕਟਿੰਗ ਟਾਈਮ ਬਹੁਤ ਖ਼ਰਾਬ ਹੋ ਜਾਣਾ ਇਸ ਲਈ ਬਹੁਤ ਸਾਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰ ਵੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਫਿਲਮੀ ਅਭਿਨੇਤਰੀ ਤੋਂ ਪ੍ਰਭਾਵਿਤ ਹੋ ਕੇ ਵਧੀਆ ਤੋਂ ਵਧੀਆ ਸੂਟ ਡਿਜ਼ਾਇਨ ਕਰ ਸਕਾਂ ਅਤੇ ਵਧੀਆ ਉਸ ਵਿੱਚ ਮਾਹਿਰ ਹੋ ਸਕਾਂ